ਜਦੋਂ ਅਸੀਂ ਜ਼ਿਆਦਾ ਲੰਬਾ ਸਮਾਂ ਸਫਰ ਕਰਦੇ ਹਾਂ ਉਦੋਂ ਸਾਨੂੰ ਰਸਤੇ ਦੇ ਵਿੱਚ ਰੈਸਟ ਰੂਮ ਦੀ ਵੀ ਜ਼ਰੂਰਤ ਪੈਂਦੀ ਹੈ ਅਤੇ ਪੈਟ ਪੈਟਰੋਲ ਗੱਡੀ ਲਈ ਪੈਟਰੋਲ ਦੀ ਵੀ ਜ਼ਰੂਰਤ ਪੈਂਦੀ ਹੈ ਗੈਸ ਗੱਡੀ ਲਈ ਗੈਸ ਸਟੇਸ਼ਨ ਦੀ ਵੀ ਜ਼ਰੂਰਤ ਪੈਂਦੀ ਆ ਅਤੇ ਆਪਣੇ ਪੇਟ ਭਰਨ ਦੇ ਲਈ ਭੋਜਨ ਦੀ ਵੀ ਜ਼ਰੂਰਤ ਹੈ ਜਿਸ ਵਿੱਚ ਰੈਸਟੋਰੈਂਟ ਆ ਹੋਟਲ ਨੇ ਜਿੱਥੇ ਬੈਠ ਕੇ ਆਪਾਂ ਖਾਣਾ ਖਾ ਸਕਦੇ ਹਾਂ ਇਹ ਸਾਰੀਆਂ ਜਰੂਰੀ ਚੀਜ਼ਾਂ ਨੇ ਰੈਸਟ ਰੂਮ ਵਰਗੀ ਇਹ ਜਿੱਥੇ ਆਪਾਂ ਲੰਬਾ ਸਮਾਂ ਡਰਾਈਵਰੀ ਕਰਨੀ ਹੈ ਜਾਂ ਬੈਠੇ ਰਹਿੰਦੇ ਹਾਂ ਉਹ ਤੋਂ ਬਾਅਦ ਰੈਸਟ ਕਰਨੀ ਵੀ ਜ਼ਰੂਰੀ ਹੈ ਰੈਸਟਿੰਗ ਰੂਮ ਵੀ ਜ਼ਰੂਰੀ ਬਹੁਤ ਹੈ ਜਿਸ ਕਰਕੇ ਰੈਸਟ ਕਰਨ ਤੋਂ ਬਾਅਦ ਹੀ ਵਿਅਕਤੀ ਕੋਈ ਵੀ ਜਾਂ ਡਰਾਈਵਰ ਆ ਸਹੀ ਤਰੀਕੇ ਨਾਲ ਗੱਡੀ ਚਲਾ ਸਕਦਾ ਅਤੇ ਜੇ ਗੱਡੀ ਦੇ ਵਿੱਚ ਪੈਟਰੋਲ ਹੋਊਗਾ ਸਹੀ ਤਰੀਕੇ ਦੇ ਨਾਲ ਤਾਂ ਗੱਡੀ ਸਹੀ ਚਲੂਗੀ ਇਸ ਕਰਕੇ ਪੈਟਰੋਲ ਵੀ ਜ਼ਰੂਰੀ ਹੈ ਅਤੇ ਭੋਜਨ ਪੇਟ ਭਰਨ ਦੇ ਲਈ ਪਹਿਲਾਂ ਵੀ ਦੱਸਿਆ ਵੀ ਭੋਜਨ ਜ਼ਰੂਰੀ ਹੈ ਰਸਤੇ ਦੇ ਵਿੱਚ ਰੁਕਣਾ ਤਾਂ ਭੋਜਨ ਵੀ ਖਾਣਾ ਹੈ ਭੋਜਨ ਦੇ ਵਿੱਚ ਉਹ ਡਿਪੈਂਡ ਕਰਦਾ ਬੰਦੇ 'ਤੇ ਤੁਸੀਂ ਕਿੱਦਾਂ ਦੀਆਂ ਚੀਜ਼ਾਂ ਲੈਂਦੇ ਹੋ